ਪਿਛਲੇ ਮਹੀਨੇ ਚੌਦ੍ਹਾਂ ਤਰੀਕ ਨੂੰ ਮੈਂ ਅਤੇ ਮੇਰਾ ਪਰਿਵਾਰ ਅਸੀਂ ਸਾਰੇ ਜਣਿਆਂ ਨੇ ਹਰਿਮੰਦਰ ਸਾਹਿਬ ਜਾਣ ਦਾ ਪਲੈਨ ਬਣਾਇਆ ਅਸੀਂ ਸਾਰਿਆਂ ਨੇ ਰਲ ਕੇ ਇੱਕ ਪ੍ਰਾਈਵੇਟ ਬਕਸ ਬੱਸ ਬੁੱਕ ਕੀਤੀ ਸਾਡੇ ਨਾਲ ਹੋਰ ਵੀ ਕੁਝ ਤੀਰਥ ਯਾਤਰੀ ਹਰਿਮੰਦਰ ਸਾਹਿਬ ਜਾਣ ਲਈ ਤਿਆਰ ਹੋ ਗਏ ਨੌਂ ਕੁ ਵਜੇ ਨਾਲ ਚੌਦ੍ਹਾਂ ਤਰੀਕ ਦੀ ਸਵੇਰ ਅਸੀਂ ਬੱਸ ਵਿੱਚ ਸਵਾਰ ਹੋ ਗਏ ਸਾਢੇ ਕੁ ਨੌਂ ਵਜੇ ਤੱਕ ਸਾਰੇ ਤੀਰਥ ਯਾਤਰੀ ਤਕਰੀਬਨ ਇਕੱਠੇ ਹੋ ਗਏ ਅਤੇ ਬੱਸ ਵਿੱਚ ਸਵਾਰ ਹੋ ਗਏ ਦਸ ਕੁ ਵਜੇ ਨਾਲ ਬੱਸ ਵਾਲੇ ਡਰੈਵਰ ਭਾਈ ਸਾਹਿਬ ਨੇ ਬੱਸ ਤੋਰ ਲਈ ਅਤੇ ਅਸੀਂ ਰਵਾਨਗੀ ਭਰੀ ਰਸਤੇ ਵਿੱਚ ਅਸੀਂ ਜਾਂਦਿਆਂ ਨੇ ਬਹੁਤ ਪ੍ਰਕਾਰ ਦੀਆਂ ਸੋਹਣੀਆਂ ਸੋਹਣੀਆਂ ਬਿਲਡਿੰਗਾਂ ਦੇਖੀਆਂ ਸਾਡੇ ਨਾਲ ਇੱਕ ਟੂਰਿਸਟ ਗਾਈਡ ਵੀ ਸੀਗਾ ਉਸ ਨੇ ਸਾਨੂੰ ਹਰ ਇੱਕ ਜਗ੍ਹਾ ਦਾ ਆਪਣਾ ਆਪਣਾ ਇਤਿਹਾਸ ਵੀ ਦੱਸਿਆ ਕਈ ਜਗ੍ਹਾ ਦਾ ਅਸੀਂ ਬਹੁਤ ਆਨੰਦ ਮਾਣਿਆ ਇਕੱਠੇ ਹੋ ਕੇ ਸਾਰੇ ਗਏ ਧਾਰਮਿਕ ਸ਼ਬਦ ਗਾਉਂਦੇ ਗਾਉਂਦੇ ਰਸਤੇ ਵਿੱਚ ਰਸਤਾ ਕਦੋਂ ਕੱਟ ਗਿਆ ਪਤਾ ਹੀ ਨਹੀਂ ਲੱਗਿਆ ਤਕਰੀਬਨ ਸ਼ਾਮ ਦੁਪਹਿਰ ਦੇ ਸ਼ਾਮ ਦੇ ਤਿੰਨ ਕੁ ਵਜੇ ਅਸੀਂ ਪਹੁੰਚ ਗਏ ਤਿੰਨ ਕੁ ਵਜੇ ਪਹੁੰਚਣ ਦੇ ਨਾਲ ਅਸੀਂ ਹਰਿਮੰਦਰ ਸਾਹਿਬ ਦਰਸ਼ਨ ਕਰੇ ਦਰਸ਼ਨ ਕਰਨ ਨੂੰ ਤਕਰੀਬਨ ਸਾਨੂੰ ਦੋ ਕੁ ਘੰਟੇ ਲੱਗ ਗਏ ਉਸ ਤੋਂ ਬਾਅਦ ਅਸੀਂ ਸੋਚਿਆ ਉਰੇ ਨੇੜੇ ਤੇੜੇ ਦੇ ਸਾਰੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਬਾਰੇ ਚਾਰ ਕੁ ਵਜੇ ਨਾਲ ਅਸੀਂ ਤਰਨਤਾਰਨ ਸਾਹਿਬ ਪਹੁੰਚੇ ਉੱਥੇ ਅਸੀਂ ਮੱਥਾ ਟੇਕਿਆ ਅਸੀਂ ਉਸ ਤੋਂ ਬਾਅਦ ਗੋਇੰਦਵਾਲ ਸਾਹਿਬ ਵੀ ਗਏ ਉੱਥੇ ਵੀ ਅਸੀਂ ਦਰਸ਼ਨ ਕੀਤੇ ਆਰਾਮ ਨਾਲ ਅਤੇ ਲੰਗਰ ਛਕਿਆ ਉੱਥੇ ਦਾ ਇਤਿਹਾਸ ਵੀ ਸਾਨੂੰ ਬੜਾ ਮਨ ਨੂੰ ਭਾਇਆ ਸਾਡੇ ਨੂੰ ਸ਼ਾਂਤੀ ਮਿਲੀ ਤੀਰਥ ਯਾਤਰਾ ਬੜੀ ਵਧੀਆ ਬੀਤੀ ਸਾਡੀ ਅਸੀਂ ਕਈ ਬੰਦੇ ਨਾਲ ਸਾਨੂੰ ਅਣਜਾਣ ਵੀ ਮਿਲੇ ਜਿਨ੍ਹਾਂ ਨਾਲ ਸਾਡੀ ਜਾਣ ਪਛਾਣ ਹੋ ਗਈ ਉਨ੍ਹਾਂ ਨੇ ਵੀ ਸਾਨੂੰ ਆਪਣੀ ਜਗ੍ਹਾ ਬਾਰੇ ਦੱਸਿਆ ਉੱਥੇ ਦਾ ਇਤਿਹਾਸ ਦੱਸਿਆ ਕਈ ਬਜ਼ੁਰਗ ਵੀ ਸੀਗੇ ਸਾਡੇ ਨਾਲ ਤੀਰਥ ਯਾਤਰਾ ਵਿੱਚ ਉਨ੍ਹਾਂ ਬਜ਼ੁਰਗਾਂ ਨੇ ਵੀ ਸਾਨੂੰ ਬਹੁਤ ਪੁਰਾਣੀਆਂ ਗੱਲਾਂ ਦੱਸੀਆਂ ਉਨ੍ਹਾਂ ਨਾਲ ਅਸੀਂ ਬੜਾ ਇੰਜੋਆਏ ਕੀਤਾ ਦਿਲ ਦੀਆਂ ਗੱਲਾਂ ਕਰੀਆਂ ਸਫ਼ਰ ਕਿਵੇਂ ਕੱਟ ਗਿਆ ਸਾਨੂੰ ਪਤਾ ਹੀ ਨਹੀਂ ਲੱਗਿਆ ਫੇਰ ਚੌਦ੍ਹਾਂ ਤਰੀਕ ਨੂੰ ਹੀ ਸ਼ਾਮ ਨੂੰ ਸਾਢੇ ਕੁ ਛੇ ਵਜੇ ਨਾਲ ਅਸੀਂ ਆਪਣੇ ਘਰ ਪਰਤ ਗਏ ਘਰ ਪਹੁੰਚਦੇ ਸਾਰ ਮੈਂ ਤਾਂ ਥੱਕ ਗਿਆ ਸੀ ਅਸੀਂ ਥੋੜ੍ਹੀ ਦੇਰ ਆਰਾਮ ਕਰਨ ਦਾ ਸੋਚਿਆ ਉਸ ਤੋਂ ਬਾਅਦ ਬੱਸ ਵਾਲੇ ਭਾਈ ਸਾਹਿਬ ਵੀ ਸਾਨੂੰ ਸਾਡੇ ਘਰ ਛੱਡ ਗਏ ਆਪਣੇ ਘਰ ਚਲੇ ਗਏ ਧੰਨਵਾਦ